ਮੈਨੂੰ ਗੀਤ ਗਾਉਣਾ ਬਹੁਤ ਪਸੰਦ ਹੈ ਜਿਵੇਂ ਕਿ ਮੈਂ ਸਕੂਲ ਦੇ ਕੰਮ ਦੇ ਨਾਲ ਨਾਲ ਘਰ ਦੇ ਕੰਮਾਂ ਸਮੇਂ ਵੀ ਜਿਵੇਂ ਕਿ ਅਸੀਂ ਸਕੂਲ ਦੇ ਵਿੱਚ ਕੋਈ ਵੀ ਪ੍ਰੋਗਰਾਮ ਚਾਹੇ ਉਹ ਧਾਰਮਿਕ ਹੈ ਚਾਹੇ ਕੋਈ ਸ਼ਹੀਦੀ ਦਿਹਾੜਾ ਗਾ ਉਸ ਦੇ ਅਕੋਰਡਿੰਗ ਕੋਈ ਭਜਨ ਕੋਈ ਗੀਤ ਕੋਈ ਕਵਿਤਾ ਉਹ ਗਾਉਂਦੇ ਹਾਂ ਜੋ ਕਿ ਮੈਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਮੈਂ ਆਪਣੇ ਘਰ ਦੇ ਵਿੱਚ ਕੰਮ ਕਰਦੇ ਸਮੇਂ ਵੀ ਗੀਤ ਗਾਉਣਾ ਪਸੰਦ ਕਰਦੀ ਹਾਂ ਭਾਵ ਕੋਈ ਨਾ ਕੋਈ ਗੀਤ ਗੁਣਗੁਣਾਉਂਦੀ ਹਾਂ ਇਸ ਤਰ੍ਹਾਂ ਹੀ ਜਿਹੜਾ ਕਿ ਗੀਤ ਗਾਉਣ ਦਾ ਜਿਹੜਾ ਜਾਂ ਗਾਉਣ ਦਾ ਰੁਝਾਨ ਆ ਉਹ ਵੱਧ ਰਿਹਾ ਹੈ